ਜਦੋਂ ਸਾਡੇ ਖੇਤਰ ਵਿੱਚ ਖਿਡਾਰੀਆਂ ਵੱਲੋਂ ਖੇਡਾਂ ਖੇਡੀਆਂ ਜਾਂਦੀਆਂ ਹਨ ਖੇਡਾਂ ਖੇਡਦੇ ਸਮੇਂ ਇਹ ਵੀ ਜ਼ਰੂਰ ਹੈ ਕਿ ਕੋਈ ਨਾ ਨਾ ਕੋਈ ਸੱਟ ਲੱਗਦੀ ਹੈ ਕੁਝ ਰਾਜ ਦੀ ਨੁਮਾਇੰਦਗੀ ਕਰਨ ਵਾਲੀਆਂ ਖੇਡਾਂ ਜਿਵੇਂ ਕਬੱਡੀ ਕ੍ਰਿਕਟ ਖੋ ਖੋ ਹੋਰ ਵੀ ਕਈ ਖੇਡਾਂ ਹਨ ਕਬੱਡੀ ਇੱਕ ਗਰਾਊਂਡ ਵਿੱਚ ਖੇਡੀ ਜਾਂਦੀ ਹੈ ਇਸ ਵਿੱਚ ਇੱਕ ਖਿਡਾਰੀ ਨੂੰ ਵਿਰੋਧੀ ਖਿਡਾਰੀਆਂ ਵੱਲੋਂ ਘੇਰਿਆ ਜਾਂਦਾ ਹੈ ਜਾਂ ਉਸ ਉੱਪਰ ਸਾਰੇ ਡਿੱਗ ਜਾਂਦੇ ਹਨ ਜਿਸ ਨਾਲ ਸਰੀਰਕ ਸੱਟ ਦਾ ਡਰ ਹੁੰਦਾ ਹੈ ਇਸ ਦੌਰਾਨ ਉੱਥੇ ਡਾਕਟਰ ਦੀ ਸੁਵਿਧਾ ਵੀ ਹੁੰਦੀ ਹੈ ਉਸ ਕੋਲ ਮਾਲਸ਼ ਲਈ ਗਰਮ ਤੇਲ ਅਤੇ ਪੱਟੀ ਵੀ ਹੁੰਦੀ ਹੈ ਕੁਝ ਉਹਨਾਂ ਕੋਲ ਸਪਰੇ ਹੁੰਦੀਆਂ ਹਨ ਜਿਸ ਨਾਲ ਉਸ ਟਾਈਮ ਹੀ ਫਰਕ ਪੈ ਜਾਂਦਾ ਹੈ ਅਤੇ ਬਾਅਦ ਵਿੱਚ ਸੱਟ ਵਾਲੇ ਖਿਡਾਰੀ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ